ਥਾਈਲੈਂਡ ਬੈਂਕੋਕ ਫੁਕੈਟ ਮਲੇਸ਼ੀਆ ਸਿੰਗਾਪੁਰ ਅਸਟ੍ਰੇਲੀਆ ਸਿਡਨੀ ਮੈਲਬਰਨ ਕੈਨੇਡਾ ਬ੍ਰਾਮਪਟੋਨ ਕਿਊਬੈਕ ਟਰੋਂਟੋ ਐਲਬਰਟਾ ਸਿਸਕੈਚੁਅਨ ਅਮਰੀਕਾ ਨਿਊਯੋਕ ਨੋਰਥ ਕੈਰੋਲੀਨਾ ਸੈਨਫਰਾਸਿਸਕੋ ਮੈਕਸੀਕੋ ਸ਼ਿਕਾਗੋ ਵੈਸਟ ਇੰਡੀਜ਼ ਕੇਨਿਆ ਇੰਗਲੈਂਡ ਯੂਨਾਈਟਡ ਕਿੰਗਡਮ ਬਰਮਿੰਗਮ ਲੰਡਨ ਲਿੰਕ ਐਸਟਰ ਬ੍ਰਿਟਿਸ਼ ਕੋਲੰਬੀਆ ਇਟਲੀ ਪੈਰਿਸ ਮਿਲਨ ਸਵਿਜਰਲੈਂਡ